ਪੰਜਾਬ ਦੇ ਵਿੱਚ ਜਿਹੜਾ ਮੁੱਖ ਸਰੋਤ ਆ ਜਿਹੜਾ ਉਹ ਤਾਂ ਪਾਣੀ ਹੀ ਹੈ ਅਤੇ ਪਾਣੀ ਦੀ ਕੁਛ ਦੁਰਵਰਤੋਂ ਇੱਧਰ ਜ਼ਿਆਦਾ ਹੋ ਰਹੀ ਹੈ ਦੀ ਕੋਈ ਸੰਭਾਲ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਪਾਣੀ ਜਿਹੜਾ ਖ਼ਰਾਬ ਜ਼ਿਆਦਾ ਕੀਤਾ ਜਾ ਰਿਹਾ ਜਿਵੇਂ ਕਿ ਕਈ ਫਸਲਾਂ ਹੀ ਇਹੋ ਜਿਹੀਆਂ ਨੇ ਜਿਹੜੀਆਂ ਕਿ ਪਾਣੀ ਬਹੁਤ ਜ਼ਿਆਦਾ ਇਹ ਜਿਹੜੀਆਂ ਲੈਂਦੀਆਂ ਹਨ ਪਾ ਫ਼ਸਲਾਂ ਨੂੰ ਪੈਦਾ ਕਰਨ ਲਈ ਪਾਣੀ ਦੀ ਜਿਵੇਂ ਕਿ ਚੌਲ ਹੋ ਗਏ ਜਿਹਨੂੰ ਵੀ ਝੋਨਾ ਕਹਿੰਦੇ ਆ ਝੋਨੇ ਦੀ ਫ਼ਸਲ ਜਿਹੜੀ ਹੈ ਸਭ ਤੋਂ ਜ਼ਿਆਦਾ ਪਾਣੀ ਦੀ ਵਰਤੋਂ ਕਰਦੀ ਹੈ ਅਤੇ ਇਹਦੇ ਵਿੱਚ ਪਾਣੀ ਦੀ ਬਹੁਤ ਬਰਬਾਦੀ ਹੁੰਦੀ ਹੈ ਅਤੇ ਸੰਭਾਲ ਵੱਲ ਇਹਦਾ ਕੋਈ ਜ਼ਿਆਦਾ ਧਿਆਨ ਨਹੀਂ ਕੀਤਾ ਜਾ ਰਿਹਾ ਕਿਉਂਕਿ ਅਜੇ ਕੋਈ ਲੋਕ ਜਾਗਰੂਕ ਨਹੀਂ ਹਨ ਇਸ ਬਾਰੇ ਜਿਸ ਲਈ ਇਹਦੀ ਸੰਭਾਲ 'ਤੇ ਕੁਛ ਕੁ ਪਰਸੈਂਟ ਲੋਕ ਹੈਗੇ ਆ ਜਿਹੜੇ ਸੰਭਾਲ ਦੇ ਬਾਰੇ ਸੋਚ ਲੈ ਸੋਚ ਰਹੇ ਐ ਜਿਹੜੇ ਕਿ ਮੀ ਇ ਇਹ ਇਹ ਸੋਚ ਰੱਖਦੇ ਹੋਏ ਮੀਂਹ ਦਾ ਪਾਣੀ ਜਿਹੜਾ ਵਾ ਉਹ ਅ ਜਮੀਨ ਦੇ ਵਿੱਚ ਵਾਪਸ ਘ ਲਈ ਉਪਰਾਲਾ ਕਰ ਰਹੇ ਹਨ ਪਰ ਬਹੁਤ ਘੱਟ ਗਿਣਤੀ ਵਿੱਚ